ਖੇਡਾਂ ਸਾਡੇ ਜੀਵਨ ਸ਼ੈਲੀ ਦਾ ਇੱਕ ਮਹੱਤਵਪੂਰਨ ਅੰਗ ਹਨ ਖੇਡਾਂ ਦੇ ਯੋਗਦਾਨ ਨਾਲ਼ ਹੀ ਆਪਣਾ ਸਰੀਰ ਮਜ਼ਬੂਤ ਅਤੇ ਤੰਦਰੁਸਤ ਰਹਿੰਦਾ ਹੈ ਖੇਡਾਂ ਸਾਨੂੰ ਇੱਕ ਯੋਗ ਅਗਵਾਈ ਦੇਣ ਦੇ ਯੋਗ ਬਣਾਉਂਦੀਆਂ ਹਨ ਸਰੀਰ ਤੰਦਰੁਸਤ ਰੱਖਦੀਆਂ ਹਨ ਅਤੇ ਅਨੁਸ਼ਾਸਨ ਵਿੱਚ ਰਹਿਣ ਦੀ ਭੂਮਿਕਾ ਅਦਾ ਕਰਦੀਆਂ ਹਨ ਇੱਕ ਚੰਗਾ ਸਪੋਰਟਸਮੈਨ ਇਹ ਇੱਕ ਚੰਗਾ ਇਨਸਾਨ ਬਣ ਸਕਦਾ ਹੈ ਇਹ ਖੇਡਾਂ ਸਾਡੇ ਜੀਵਨ ਦੇ ਲਈ ਅਤੀ ਜ਼ਰੂਰੀ ਹਨ ਖੇਡਾਂ ਦੇ ਨਾਲ਼ ਨਾਲ਼ ਹੀ ਆਪਣਾ ਜੀਵਨ ਸ਼ੈਲੀ ਉੱਚੀ ਚੁੱਕੀ ਜਾ ਸਕਦੀ ਹੈ ਅਤੇ ਸ ਚੰਗੇ ਖਿਡਾਰੀ ਸਾਡੇ ਸਤਿਕਾਰਯੋਗ ਦਾ ਵੀ ਪਾਤਰ ਬਣਦੇ ਬਣਦੇ ਹਨ ਅਤੇ ਖੇਡਾਂ ਦੇ ਮਹੱਤਵ ਨੂੰ ਜਾਣਨ ਲਈ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਹੀ ਪਤਾ ਲੱਗਦਾ ਹੈ ਅਤੇ ਆਪਣੇ ਇੱਕ ਤੰਦਰੁਸਤ ਮਨੁੱਖ ਉਹੀ ਹੈ ਜੋ ਨਿੱਤ ਖੇਡਾਂ ਖੇਡਾਂ ਖੇਡਦਾ ਹੈ ਖੇਡ ਕਿਸੇ ਕਿਸਮ ਦੀ ਵੀ ਹੋ ਹੋ ਸਕਦੀ ਹੈ ਸਰੀਰ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ ਇਸ ਨਾਲ਼ ਸਪੋਰਟਸਮੈਨ ਦੇ ਨਾਲ਼ ਨਾਲ਼ ਇੱਕ ਚੰਗਾ ਇਨਸਾਨ ਬਣਨ ਦੀ ਵੀ ਇਹ ਦਿੰਦੇ ਇੱਕ ਗਰੁੱਪ 'ਚ ਰਹਿ ਕੇ ਅਨੁਸ਼ਾਸਨ 'ਚ ਰਹਿ ਕੇ ਅਤੇ ਇਕ ਲਾਮਬੰਦੀ 'ਚ ਰਹਿ ਕੇ ਇੱਕ ਗੁਰੁੱਪ 'ਚ ਰਹਿ ਕੇ ਇੱਕ ਚੰਗਾ ਇਨਸਾਨ ਬਣਨ ਦਾ ਸੁਪਨਾ ਅਦਾ ਕਰਦੀਆਂ ਹਨ ਅਤੇ ਇਹ ਹਮੇ ਹਮੇਸ਼ਾ ਖਿਡਾਰੀ ਤੰਦਰੁਸਤ ਤੰਦਰੁਸਤ ਰਹਿੰਦੇ ਹਨ ਅਤੇ ਹਰੇਕ ਹਰ ਕਿਸਮ ਦੀ ਲਈ ਤਾਂ ਸਹਾਇਤਾ ਲਈ ਤਤਪਰ ਰਹਿੰਦੇ ਹਨ ਅਸੇ ਇਹ ਆਪਣੇ ਸਮਾਜ ਦਾ ਆਪਣੇ ਜ ਜ਼ਿਲ੍ਹੇ ਦਾ ਆਪਣੇ ਦੇਸ਼ ਦਾ ਨਾਮ ਉੱਚਾ ਕਰਦੇ ਹਨ ਅਜਿਹੇ ਖਿਡਾਰੀ 'ਤੇ ਸਾਨੂੰ ਮਾਣ ਰਹਿੰਦਾ ਹੈ ਅਤੇ ਹਰੇ ਸਰੀਰ ਦੇ ਪੱਠੇ ਮਜ਼ਬੂਤ ਆਦਿ ਆਦਿ ਰੱਖ ਰੱਖਦੇ ਹਨ